ਮੇਰੀ ਲਿਖਣ ਦੀ ਪ੍ਰਕਿਰਿਆ ਇੱਕ ਸੁਖਦ ਤਰੀਕੇ ਨਾਲ ਸਮਝੀ ਜਾ ਸਕਦੀ ਹੈ ਮੈਂ ਆਮ ਤੌਰ 'ਤੇ ਪਹਿਲਾਂ ਡਰਾਫਟ ਲਿਖਦੀ ਹਾਂ ਫਿਰ ਮੈਂ ਆਪਣੀ ਪ੍ਰਸਤੂਤੀ ਨੂੰ ਸੁਧਾਰਦੀ ਹਾਂ ਤਾਂ ਜੋ ਕਿ ਮੇਰੇ ਵਿਚਾਰ ਸਪੱਸ਼ਟ ਅਤੇ ਵਿਵੇਕੀ ਹੋ ਸਕਣ ਮੈਨੂੰ ਪ੍ਰਮਾਣਿਕਤਾ ਦੇ ਮਾਪਦੰਡ ਬਾਰੇ ਬਹੁਤ ਹੀ ਚਿੰਤਾ ਹੁੰਦੀ ਹੈ ਮੈਂ ਚਾਹੁੰਦੀ ਹਾਂ ਕਿ ਮੇਰੇ ਲਿਖਣ ਵਿੱਚ ਕੋਈ ਗਲਤੀਆਂ ਨਾ ਹੋਣ ਜਾਂ ਲਿਖਣ ਵਾ ਵੇਲੇ ਮੈਨੂੰ ਘੱਟ ਤੋਂ ਘੱਟ ਗਲਤੀਆਂ ਹੋਣ ਤਾਂ ਜੋ ਪੜ੍ਹਨ ਵਾਲੇ ਆਸਾਨੀ ਨਾਲ ਮੇਰਾ ਸੰਦੇਸ਼ਾ ਪੜ੍ਹ ਸਕਣ ਮੈਂ ਸੰਦੇਹਾ ਅਤੇ ਧਿਆਨ ਨਾਲ ਕੰਮ ਕਰਦੀ ਹਾਂ ਅਤੇ ਲਿਖਣ ਦੇ ਤਰੀਕੇ ਨੂੰ ਵੀ ਸੁਧਾਰਦੀ ਰਹਿੰਦੀ ਹਾਂ ਲਿਖਣ ਦੇ ਸਮੇਂ ਮੈਂ ਆਮ ਤੌਰ 'ਤੇ ਪ੍ਰੋਫੈਸ਼ਨਲ ਲੇਖਕਾਂ ਦੀ ਸਲਾਹ ਲੈਂਦੀ ਹਾਂ ਜੋ ਮੇਰੇ ਲੇਖਣ ਨੂੰ ਮਹੱਤਵਪੂਰਨ ਬਣਾਉਂਦੇ ਹਨ ਮੇਰੇ ਲੇਖਨ ਪੜ੍ਹਨ ਵਾਲੇ ਨੂੰ ਸਹੀ ਰਾਹ ਦਿਖਾਵਣਗੇ ਇਸ ਕਰਕੇ ਮੈਂ ਆਪਣੇ ਲੇਖਨਾਂ ਨੂੰ ਸੁਧਾਰਦੀ ਰਹਿੰਦੀ ਹਾਂ ਜਾਂ ਸਧਾਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਮੇਰੇ ਲੇਖਣ ਵਿੱਚ ਮੈਨੂੰ ਆਪਣੇ ਵਿਚਾਰ ਨੂੰ ਸਾਫ ਤੌਰ 'ਤੇ ਪ੍ਰਕਾਸ਼ਿਤ ਕਰਨ ਦਾ ਸੁਨਹਿਰਾ ਮੌਕਾ ਮਿਲਦਾ ਹੈ ਇਸ ਤਰ੍ਹਾਂ ਲਿਖਣ ਨਾਲ ਮੈਨੂੰ ਆਪਣੇ ਆਪ ਨੂੰ ਸਮਝਣ ਅਤੇ ਅਨੂਠੀ ਸੋਚ ਨੂੰ ਵਾਧਾ ਦੇਣ ਦਾ ਮੌਕਾ ਮਿਲਦਾ ਹੈ